ਯੋਗ ਨੂੰ ਸ਼ੌਂਕ ਵਜੋਂ ਅਪਣਾਉਣ ਦੇ ਲਈ ਮੈਨੂੰ ਮੇਰੇ ਯੋਗਾ ਇੰਸਟਰਕਟਰ ਨੇ ਪ੍ਰੇਰਿਤ ਕੀਤਾ ਕਿਉਂਕਿ ਮੈਂ ਬਹੁਤ ਸਾਲਾਂ ਤੋਂ ਪਰੇਸ਼ਾਨ ਸੀ ਡਿਸਕ ਦੀ ਪ੍ਰੋਬਲਮ ਦੇ ਕਰਕੇ ਡਿਸਕ ਦੀ ਪ੍ਰੋਬਲਮ ਮੈਨੂੰ ਬਹੁਤ ਲੰਬੇ ਸਮੇਂ ਤੋਂ ਮਹਿਸੂਸ ਹੋ ਰਹੀ ਸੀ ਅਤੇ ਦਿੱਕਤ ਸੀ ਜਿਸ 'ਚ ਮੈਂ ਤੁਰ ਵੀ ਠੀਕ ਨਹੀਂ ਸੀ ਸਕਦਾ ਬੈਠਣਾ ਉੱਠਣਾ ਸੌਣਾ ਲੇਟਣਾ ਹਰ ਵਕਤ ਮੇਰੇ ਦਰਦ ਰਹਿੰਦੀ ਸੀ ਅਤੇ ਇਸ ਦੇ ਲਈ ਮੈਨੂੰ ਇੱਕ ਯੋਗ ਕਰਨ ਵਾਲੇ ਅਚਾਰਿਆ ਮਿਲੇ ਜਿਨ੍ਹਾਂ ਨੇ ਮੈਨੂੰ ਯੋਗ ਦੇ ਪ੍ਰਤੀ ਪ੍ਰੇਰਿਤ ਕੀਤਾ ਕਿ ਜੋਗ ਕਰਨ ਨਾਲ ਤੁਹਾਡੀ ਇਹ ਪ੍ਰੋਬਲਮ ਜੜੋਂ ਖਤਮ ਹੋ ਸਕਦੀ ਹੈ ਜਦੋਂ ਮੈਂ ਉਹਨਾਂ ਦੀ ਅਗਵਾਈ ਦੇ ਵਿੱਚ ਯੋਗ ਕਰਨਾ ਸ਼ੁਰੂ ਕੀਤਾ ਤਾਂ ਇਹ ਯੋਗ ਦੀ ਪ੍ਰੋਬਲਮ ਦੇ ਨਾਲ ਹੌਲੀ ਹੌਲੀ ਮੈਨੂੰ ਸ਼ਰੀਰਕ ਤੌਰ 'ਤੇ ਤੰਦਰੁਸਤੀ ਮਿਲਣੀ ਸ਼ੁਰੂ ਹੋਈ ਮੈਂ ਇਸ ਇਸ ਜਦੋਂ ਮੈਂ ਠੀਕ ਹੋਣ ਲੱਗ ਗਿਆ ਅਤੇ ਮੈਂਟਲੀ ਤੌਰ 'ਤੇ ਮੈਂ ਠੀਕ ਹੋਣ ਲੱਗ ਪਿਆ ਫਿਜ਼ੀਕਲੀ ਤੌਰ 'ਤੇ ਜਦੋਂ ਮੈਂ ਠੀਕ ਹੋਣ ਲੱਗ ਪਿਆ ਅਤੇ ਯੋਗ ਵੱਲ ਮੇਰਾ ਇੰਟਰਸਟ ਹੋਰ ਬਣਦਾ ਗਿਆ ਯੋਗ ਮੇਰੀ ਰੁਚੀ ਬਣਦੀ ਗਈ ਮੇਰੀ ਡਿਸਕ ਦੀ ਪ੍ਰੋਬਲਮ ਅੱਜ ਦੀ ਡੇਟ ਦੇ ਵਿੱਚ ਠੀਕ ਹੋ ਚੁੱਕੀ ਆ ਬਟ ਮੈਂ ਯੋਗ ਕਰਨਾ ਨਹੀਂ ਛੱਡਿਆ ਯੋਗ ਨੂੰ ਮੈਂ ਆਪਣੇ ਦਿਨ ਚਰਿਆ ਦੇ ਵਿੱਚ ਪੂ ਪੂਰੀ ਚੰਗੀ ਤਰ੍ਹਾਂ ਅਪਣਾ ਚੁੱਕਾ ਹਾਂ ਯੋਗ ਮੇਰਾ ਸ਼ੌਂਕ ਮੇਰੀ ਸਿਹਤ ਨੂੰ ਠੀਕ ਰੱਖਣ ਦੇ ਲ ਲਈ ਸ਼ੌਂਕ ਵੀ ਕਹਿ ਸਕਦੇ ਹੋ ਮੇਰੀ ਰੁਚੀ ਵੀ ਕਹਿ ਸਕਦੇ ਹੋ ਮੇਰੀ ਜ਼ਰੂਰਤ ਵੀ ਕਹਿ ਸਕਦੇ ਹੋ ਯੋਗ ਮੇਰੇ ਲਈ ਇੱਕ ਬਹੁਤ ਵੱਡਾ ਮ ਮੇਰਾ ਮੇਰੀ ਰੂਚੀ 'ਚ ਸ਼ਾਮਿਲ ਹੋ ਕੇ ਯੋਗ ਨੇ ਮੈਨੂੰ ਤੰਦਰੁਸਤ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਕਿ ਯੋਗ ਦੇ ਪ੍ਰਤੀ ਜਾਗਰੂਕ ਕਰਨ ਲਈ ਵੀ ਮੈਨੂੰ ਮੈ ਉਸ ਮਨੁੱਖ ਦਾ ਬਹੁਤ ਆਭਾਰੀ ਹਾਂ ਜਿਹਨੇ ਮੈਨੂੰ ਯੋਗ ਨੂੰ ਅਪਣਾਉਣ ਦੇ ਲਈ ਔਰ ਆਪਣੀ ਦਿਨ ਚਰਿਆਂ 'ਚ ਜੋੜਨ ਦੇ ਲਈ ਮੈਨੂੰ ਪ੍ਰੇਰਿਤ ਕੀਤਾ ਯੋਗ ਕਰਨ ਲਈ ਮੈਂ ਸਭ ਨੂੰ ਇੱਕ ਵਾਰ ਆਪਣੀ ਇੱਕ ਪ੍ਰਾਰਥਨਾ ਕਰਾਂਗਾ ਕਿ ਯੋਗ ਨੂੰ ਤੁਸੀਂ ਆਪਣੇ ਦਿਨ ਚਰਿਆ ਦੇ ਵਿੱਚ ਅਪਣਾਓ ਅਤੇ ਆਪਣੀ ਰੁਚੀ ਬਣਾਓ